ਪਹਿਲੇ ਸਮੇਂ ਵਿੱਚ ਫੋਟੋਗ੍ਰਾਫੀ ਵਾਈਟ ਸੀ ਅਤੇ ਹੌਲੀ ਹੌਲੀ ਸਮੇਂ ਬਦਲਿਆ ਤਾਂ ਰੰਗਦਾਰ ਫੋਟੋਆਂ ਖਿੱਚੀਆਂ ਜਾਣ ਲੱਗੀਆਂ ਪੁਰਾਣੇ ਕੈਮਰਿਆਂ ਵਿੱਚ ਟੈਕਨੋਲਜੀ ਦੀ ਘੱਟ ਵਰਤੋਂ ਹੁੰਦੀ ਸੀ ਪਰ ਬਾਅਦ ਵਿੱਚ ਇਹ ਸਾਰਾ ਕੰਮ ਮੋਬਾਈਲ ਫੋਨਾਂ ਦੁਆਰਾ ਕੀਤਾ ਜਾਣ ਲੱਗਾ ਕਿਉਂਕਿ ਇਸ ਵਿੱਚ ਫੋਟੋਆਂ ਵੀ ਖਿੱਚੀਆਂ ਜਾ ਸਕਦੀਆਂ ਹਨ ਅਤੇ ਕਿਸੇ ਨਾਲ ਗੱਲਾਂ ਅਤੇ ਹੋਰ ਬਹੁਤ ਕੁਝ ਅੱਜ ਇਸ ਮੋਬਾਈਲ ਕੈਮਰਿਆਂ ਦੁਆਰਾ ਕੀਤਾ ਜਾਣ ਲੱਗ ਗਿਆ ਇਹ ਇੱਕ ਬਹੁਤ ਵੱਡੀ ਖੋਜ ਹੈ ਇਸਦੇ ਹਰ ਮਨੁੱਖ ਦੀ ਜ਼ਿੰਦਗੀ ਉੱਤੇ ਗਹਿਰਾ ਅਸਰ ਪਾਇਆ ਏ ਇਸ ਨੇ ਮਨੁੱਖ ਦੀ ਜ਼ਿੰਦਗੀ ਬਹੁਤ ਸੌਖੀ ਬਣਾ ਦਿੱਤੀ ਹੈ ਅਤੇ ਸਮੇਂ ਦੀ ਬੱਚਤ ਹੋਣ ਲੱਗ ਗਈ ਹੈ ਆਧੁਨਿਕ ਯੁੱਗ ਦਾ ਸਭ ਤੋਂ ਵਧੀਆ ਅਵਿਸ਼ਕਾਰ ਹੈ